ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਓਕੇ ਮੈਮ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਓ ਹੋ ਹੋ ਹੋ ਸੋਰੀ ਮੈਮ ਮੈਂ ਆਊਟ ਔਫ਼ ਟਾਊਨ ਸੀ ਅਤੇ ਮੇਰੇ ਮਾਇੰਡ ਵਿੱਚੋਂ ਸਕਿੱਪ ਹੋ ਗਿਆ ਸੀ ਤੁਸੀਂ ਇੱਦਾਂ ਕਰੋ ਮੈਨੂੰ ਹਾਂਜੀ ਹਾਂਜੀ ਤੁਸੀਂ ਇੱਦਾਂ ਕਰੋ ਆਪਣੇ ਬੈਂਕ ਦੀ ਡਿਟੇਲ ਸੈਂਡ ਕਰ ਦਿਉ ਮੈਂ ਤੁਹਾਨੂੰ ਅਮਾਊਂਟਸ ਜਿਹੜਾ ਉਹ ਸੈਂਡ ਕਰ ਦੇਵਾਂਗੀ ਮੈਮ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਅੱਜ ਹੀ ਸੈਂਡ ਕਰ ਦਿੰਦੀ ਹਾਂ ਹੋਰ ਦੱਸੋ ਰਾਹੁਲ ਦਾ ਉੱਦਾਂ ਡਾਂਸ ਵਗੈਰਾ ਵਧੀਆ ਹੈਗਾ ਹਾਂਜੀ ਹਾਂਜੀ ਇੰਪਰੂਵਮੈਂਟ ਤਾਂ ਹੈਗੀ ਹੈ ਹੁਣ ਉਹ ਤਾਂ ਐਕਸਾਈਟਿਡ ਹੀ ਬੜਾ ਹੁੰਦਾ ਹੈਗਾ ਜਾਣ ਲਈ ਹਾਂਜੀ ਹਾਂਜੀ ਚਲੋ ਠੀਕ ਹੈ ਮੈਮ ਹਾਂਜੀ ਹਾਂਜੀ ਤੁਸੀਂ ਬੈਂਕ ਡਿਟੇਲ ਸੈਂਡ ਕਰ ਦਿਓ ਮੈਂ ਤੁਹਾਨੂੰ ਹੁਣੇ ਪੇਮੈਂਟ ਕਰ ਦਿੰਦੀ ਹਾਂ ਓਕੇ ਥੈਂਕ ਯੂ ਮੈਮ